ਹੈਲੋ ਹੈਲੋ ਤਜਿੰਦਰ ਕਿਵੇਂ ਓਂ ਮੈਂ ਵੀ ਵਧੀਆ ਮੇਰਾ ਨਾਮ ਇਕਬਾਲ ਹੈ ਠੀਕ ਹੈ ਅਤੇ ਮਤਲਬ ਕਿ ਤੁਸੀਂ ਦੇਖਿਆ ਹੋਣਾ ਕਿ ਅੱਜ ਕੱਲ੍ਹ ਮਤਲਬ ਆਪਣੇ ਪੰਜਾਬ ਵਿੱਚ ਸਿੰਗਰਸ ਕਿੰਨੀ ਜ਼ਿਆਦਾ ਮਤਲਬ ਪਾਪੂਲਰ ਹੋ ਗਏ ਆ ਜੀ ਅਤੇ ਹਾਂਜੀ ਜਿਵੇਂ ਦਿਲਜੀਤ ਦੋਸਾਂਝ ਹੋ ਗਿਆ ਸਿੱਧੂ ਮੂਸੇਵਾਲਾ ਹੋ ਗਿਆ ਉਹਨੇ ਆਪਣੇ ਪੰਜਾਬ ਨੂੰ ਮਤਲਬ ਕਿੰਨਾ ਜ਼ਿਆਦਾ ਪਾਪੂਲਰ ਕਰਤਾ ਹੋਇਆ ਮਤਲਬ ਹੋਲੀਵੁੱਡ ਬੋਲੀਵੁੱਡ ਕਿ ਮਤਲਬ ਵਰਲਡ ਦਾ ਮਤਲਬ ਬੈਸਟ ਬਣਾ ਦਿੱਤਾ ਹੋਇਆ ਪੰਜਾਬ ਨੂੰ ਹਾਂ ਮਤਲਬ ਕਿ ਜਿੱਦਾਂ ਮਤਲਬ ਤੁਸੀਂ ਕਹਿ ਰਹੇ ਹੋ ਕਿ ਆਪਣੇ ਪੰਜਾਬ ਨੂੰ ਜਾਣਦੇ ਹਾਂ ਹੈ ਨਾ ਲਾਈਕ ਕਿ ਫੇਮਸ ਕਰ ਦਿੱਤਾ ਹੋਇਆ ਏ ਉਹਨਾਂ ਨੇ ਉਹ ਮਤਲਬ ਕਿ ਜਿਹੜੇ ਲੋਕ ਆ ਉਹਨਾਂ ਨੂੰ ਪੰਜਾਬੀ ਨਹੀਂ ਸਮਝ ਆਉਂਦੀ ਬਟ ਉਹ ਮਤਲਬ ਕਿ ਆਪਣੇ ਪੰਜਾਬੀ ਦੇ ਸਿੱਧੂ ਮੂਸੇਆਲੇ ਦੇ ਗਾਣੇ ਸੁਣਨਾ ਬਹੁਤ ਜ਼ਿਆਦਾ ਪਸੰਦ ਕਰਦੇ ਆ ਅਤੇ ਸਪੈਸ਼ਲੀ ਉਹ ਪੰਜਾਬੀ ਸਿੱਖ ਵੀ ਗਏ ਆ ਫੋਰ ਦਾ ਸੌਂਗ ਹਾਂਜੀ ਚਲੋ ਠੀਕ ਹੈ ਓਕੇ ਬਾਏ